ਸਤਿ ਸ਼੍ਰੀ ਅਕਾਲ ਸਰ ਮੈਂ ਅਰਸ਼ਦੀਪ ਕੌਰ ਬੋਲ ਰਹੀ ਹਾਂ ਮੈਂ ਨਾ ਕੁਝ ਸਮੇਂ ਪਹਿਲਾਂ ਔਡਰ ਕੀਤਾ ਸੀ ਤੁਹਾਡੇ ਸੈਬ ਢਾਬੇ ਵਾਲਿਆਂ ਤੋਂ ਕਿ ਮੇਰੇ ਘਰ ਨਾ ਇੱਕ ਪ੍ਰੋਗਰਾਮ ਸੀਗਾ ਅਤੇ ਮੇਰੇ ਬਹੁਤ ਸਾਰੇ ਗੈਸਟ ਆਉਣੇ ਸੀ ਜਿਹਦੇ ਕਰਕੇ ਮੈਂ ਕੁਛ ਸਮਾਨ ਔਡਰ ਕੀਤਾ ਸੀਗਾ ਜਿਵੇਂ ਕਿ ਦਾਲ ਮੱਖਣੀ ਸ਼ਾਹੀ ਪਨੀਰ ਕੜਾਈ ਪਨੀਰ ਮਿਕਸ ਵੈੱਜ ਰਾਇਤਾ ਚਾਵਲ ਤੰਦੂਰੀ ਰੋਟੀਆਂ ਮਿ ਮਿੱਸੀ ਰੋਟੀ ਲੱਛਾ ਪਰੌਂਠਾ ਲੱਸੀ ਵੀ ਸਾਰੀਆਂ ਚੀਜ਼ਾਂ ਔਡਰ ਕੀਤੀਆਂ ਸੀਗੀਆਂ ਇਹ ਮੈਂ ਤੁਹਾਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ ਸ਼ਾਮ ਤੱਕ ਪਹੁੰਚਾ ਦਿਓ ਸ਼ਾਮ ਦੇ ਸਾਢੇ ਕੁ ਪੰਜ ਵਜੇ ਤੱਕ ਇਹ ਸਾਰਾ ਸਮਾਨ ਜਿਹੜਾ ਹੈ ਪਹੁੰਚਾ ਦਿਓ ਅਤੇ ਇਹਨਾਂ ਦੀ ਜਿਹੜੀ ਪੇਮੈਂਟ ਬਣਦੀ ਆ ਉਹ ਮੈਂ ਤੁਹਾਨੂੰ ਔਫਲਾਈਨ ਨਾਲ ਹੀ ਕਰ ਦਾਂਗੀ ਜਦੋਂ ਮੈਨੂੰ ਸਮਾਨ ਦੇਣ ਆਉਂਗੇ ਤੁਸੀਂ ਅਤੇ ਮੇਰਾ ਐਡਰੈਸ ਹੈਗਾ ਆ ਸੱਦਾ ਮਾਜਰਾ ਆ ਪਿੰਡ ਅਤੇ ਮੇਰਾ ਘਰ ਸ ਸਰਕਾਰੀ ਸਕੂਲ ਦੇ ਮਤਲਬ ਕੋਲ ਆ ਸਾਹਮਣੇ ਉਹਦੇ ਘ ਸਾਹਮਣੇ ਘਰ ਮੇਰਾ ਆ ਅਤੇ ਉੱਥੇ ਦੇ ਜਿਓ ਮੈਨੂੰ ਅਤੇ ਕੁਝ ਡਿਸਕਾਊਂਟ ਵਗੈਰਾ ਵੀ ਕਰ ਦਿਓ ਹੋ ਸਕਿਆ ਤਾਂ ਹੈ ਨਾ ਅਤੇ ਧੰਨਵਾਦ ਤੁਹਾਡਾ